ਹੈਲੋ ਹਾਂਜੀ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਦਿਨ 'ਚ ਚਾਰ ਸੈਸ਼ਨ ਲੱਗਦੇ ਆ ਸਵੇਰੇ ਅੱਠ ਵਜੇ ਲੱਗਦਾ ਵਾ ਨੌਂ ਵਜੇ ਤੱਕ ਫਿਰ ਇੱਕ ਗਿਆਰਾਂ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕ ਲੱਗਦਾ ਇੱਕ ਸ਼ਾਮ ਨੂੰ ਲੱਗਦਾ ਚਾਰ ਤੋਂ ਪੰਜ ਅਤੇ ਇੱਕ ਲਾਸਟ ਸੈਸ਼ਨ ਜਿਹੜਾ ਲੱਗਦਾ ਉਹ ਲੱਗਦਾ ਛੇ ਤੋਂ ਸੱਤ ਵਜੇ ਤੱਕ ਹਰ ਸੈਕਸ਼ਨ ਵਿੱਚ ਦਸ ਹੁੰਦੇ ਆ ਐਪਰੋਕਸ ਹਾਂਜੀ ਇੰਦਰਾ ਕਲੋਨੀ ਸੈਂਟਰ ਹੈ ਉੱਥੇ ਹੀ ਲੱਗਦੀ ਆ ਉਹਦੇ ਲਈ ਫਿਰ ਤੁਹਾਨੂੰ ਰਜਿਸਟਰੇਸ਼ਨ ਕਰਾਉਣੀ ਪਊਗੀ ਹਾਂ ਰਜਿਸਟਰੇਸ਼ਨ ਕਰਾ ਕੇ ਫਿਰ ਤੁਸੀਂ ਚਾਰਜਿਸ ਵਗੈਰਾ ਪਤਾ ਕਰਕੇ ਫਿਰ ਤੁਸੀਂ ਜੁਆਇਨ ਕਰ ਸਕਦੇ ਹੋ

ਪੰਦਰਾਂ ਸੌ ਮਤਲਬ ਇੱਕ ਇੱਕ ਘੰਟੇ ਦਾ ਸੈਸ਼ਨ ਹੁੰਦਾ ਕਦੀ ਪੰਤਾਲੀ ਮਿੰਟ ਦਾ ਵੀ ਹੋ ਜਾਂਦਾ ਅਤੇ ਤਾੜ ਆਸਣ ਵਗੈਰਾ ਅਤੇ ਸਟਰੈਚਿੰਗ ਵਗੈਰਾ ਇਹ ਸਾਰੇ ਜਿੰਨੇ ਵੀ ਆਸਣ ਵਗੈਰਾ ਹੁੰਦੇ ਆ ਇੱਕ ਦਿਨ 'ਚ ਘੱਟੋ ਘੱਟ ਛੇ ਸੱਤ ਆਸਣ ਮਤਲਬ ਕਿ ਕਰਵਾ ਦਿੰਦੇ ਆ ਨਹੀਂ ਇੱਕ ਸੈਕਸ਼ਨ 'ਚ ਮੈਕਸੀਮਮ ਪੰਦਰਾਂ ਰੱਖੇ ਆ ਹਾਂਜੀ ਨਹੀਂ ਲੇਡੀਜ਼ ਨੇ ਵੀ ਜੁਆਇਨ ਕੀਤਾ ਵਾ ਜਿਹੜਾ ਲੇਡੀਜ਼ ਦਾ ਸੈਸ਼ਨ ਆ ਉਹ ਸ਼ਾਮ ਨੂੰ ਲੱਗਦਾ

ਦੇਖ ਲਓ ਤੁਹਾਡੀ ਆਪਣੀ ਇੱਛਾ ਪੰਦਰਾਂ ਸੌ ਹਾਂਜੀ ਠੀਕ ਹੈ ਓਕੇ